ਸਾਡੇ ਫਾਜ਼ਿਲਕਾ ਵਿੱਚ ਕੁਦਰਤੀ ਸਰੋਤ ਰੇਤ ਹੈ ਇਹ ਰੇਤ ਸਾਰੇ ਭਾਰਤ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈ ਕਿਉਂਕਿ ਹਜ਼ਾਰਾਂ ਸਾਲ ਪਹਿਲੇ ਫਾਜ਼ਿਲਕਾ ਦੀ ਧਰਤੀ ਦੇ ਨਾਲ ਦਰਿਆ ਨਿਕਲਦਾ ਹੈ ਜੋ ਸਤਲੁਜ ਹੈ ਵੈਸੇ ਪੰਜਾਬ ਵਿੱਚ ਪੰਜ ਦਰਿਆ ਹਨ ਲੇਕਿਨ ਸਤਲੁਜ ਅੰਮ੍ਰਿਤਸਰ ਤੋਂ ਲੈ ਕੇ ਫਾਜ਼ਿਲਕਾ ਹੁੰਦਾ ਹੋਇਆ ਮੁਲਤਾਨ ਦੀ ਤਰਫ ਮੁੜ ਜਾਂਦਾ ਹੈ ਇੱਥੇ ਰੇਤ ਦੀਆਂ ਸਿੱਲੀਆਂ ਮੇਰੇ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਦੇਖ ਰਿਹਾ ਟਰੱਕਾਂ ਦੇ ਟਰੱਕ ਸਾਰੇ ਭਾਰਤ ਵਿੱਚ ਜਾਂਦੇ ਹਨ ਹੋਰ ਇਹਨਾਂ ਦੇ ਨਾਲ ਮਕਾਨ ਬਣਾਏ ਜਾਂਦੇ ਹਨ ਜਾਂ ਹੋਰ ਯੂਜ ਹੋਣ ਵਾਲੀਆਂ ਚੀਜ਼ਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਰੇਤ ਲਿਜਾਣਾ ਇੰਨਾ ਸੌਖਾ ਹੈ ਕਿ ਖੱਡਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਟਰੱਕ ਲੱਗ ਜਾਂਦੇ ਹਨ ਜੋ ਵਾਰੀ ਸਿਰ ਇੱਕ ਟਰਿਕ ਇੱਕ ਟਰੱਕ ਭਰ ਲੈਂਦੇ ਹਨ ਇਸ ਤੋਂ ਪਹਿਲੇ ਇਹ ਨਿਯਮ ਸੀ ਕਿ ਸਿਰਫ ਭਰਾਈ ਦੇ ਹੀ ਪੈਸੇ ਲੱਗਦੇ ਸਨ ਔਰ ਹੁਣ ਇਹ ਹੋ ਗਿਆ ਹੈ ਕਿ ਟਰੱਕ ਦੇ ਖਰਚੇ ਦੇ ਨਾਲ ਨਾਲ ਭਰਾਈ ਦਾ ਖਰਚਾ ਵੀ ਅਤੇ ਰੇਤਾ ਮੁੱਲ ਵੀ ਵਿਕਣ ਲੱਗ ਗਿਆ ਹੈ ਇਸ ਕਰਕੇ ਅੱਜ ਦੀਆਂ ਗਤੀਵਿਧੀਆਂ ਵਿੱਚ ਰੇਤਾ ਹੁਣ ਦੋ ਨੰਬਰ ਦਾ ਰਹਿ ਗਿਆ ਹੈ ਹੁਣ ਅਸਲੀ ਰੇਤਾ ਨਹੀਂ ਰਹਿ ਗਿਆ ਹੈ ਪਹਿਲੇ ਵਾਲੇ ਰੇਤੇ ਵਿੱਚ ਅਸੀਂ ਛੋਟੇ ਛੋਟੇ ਘਰ ਵੀ ਬਣਾਉਂਦੇ ਸੀ ਪੈਰਾਂ 'ਤੇ ਉਪਜਾਊ ਚੀਜ਼ਾਂ ਵੀ ਰੱਖਦੇ ਸੀ ਉਹਨਾਂ ਦੇ ਔਰ ਰੇਤਾਂ ਦੇ ਵਿੱਚ ਹੀ ਕਈ ਤਰ੍ਹਾਂ ਦੇ ਪੌਦੇ ਵੀ ਉੱਗ ਪੈਂਦੇ ਸਨ ਲੇਕਿਨ ਰੇਤ ਦੀ ਸਿੱਲੀ ਉਵੇਂ ਦੀ ਉਵੇਂ ਕੱਢ ਲਈ ਜਾਂਦੀ ਸੀ ਅੱਜ ਰੇਤ ਦੀ ਸਿੱਲੀ ਨਹੀਂ ਨਿਕਲਦੀ ਅੱਜ ਤਾਂ ਵਿੱਚ ਮਿੱਟੀ ਮਿਲੀ ਹੋਈ ਹੈ ਇਹਨਾਂ ਖੱਡਾਂ ਦਾ ਪ੍ਰਯੋਗ ਹੁਣ ਸਿਰਫ ਰਾਜਨੇਤਾ ਲੋਕ ਆਪਣੇ ਨਿੱਜੀ ਸਵਾਰਥਾਂ ਵਿੱਚ ਪ੍ਰਯੋਗ ਕਰ ਰਹੇ ਹਨ ਇਸ ਕਰਕੇ ਹੁਣ ਜਿਹੜੇ ਰੇਤੇ ਦਾ ਤਰੀਕਾ ਹੈ ਹੁਣ ਇਹ ਦਰਿਆ ਦੇ ਨਾਲ ਨਾਲ ਸਾਰੀਆਂ ਖੱਡਾਂ ਹੀ ਰਹਿ ਗਈਆਂ ਹਨ ਜਿਹੜੇ ਖਤਰੇ ਦਾ ਕਾਰਨ ਬਣ ਗਈਆਂ ਹਨ ਹੁਣ ਰੇਤ ਨਹੀਂ ਰਹਿ ਗਿਆ ਹੈ ਹੁਣ ਰੇਤ ਨਹੀਂ ਰਹਿ ਗਿਆ